ਅਸੀਂ ਵਿਆਹ ਵਿੱਚ ਬਹੁਤ ਜ਼ਿਆਦਾ ਆਨੰਦ ਮਾਣਦੇ ਹਨ ਜਿਵੇਂ ਕਿ ਸੰਗੀਤ ਵਿੱਚ ਅਸੀਂ ਜਿਵੇਂ ਕਿ ਲੇਡੀਜ਼ ਹੋ ਗਈ ਉਹ ਬੋਲੀਆਂ ਪਾਉਂਦੀਆਂ ਹਨ ਅਤੇ ਗਿੱਧਾ ਪਾਉਣਾ ਬਹੁਤ ਪਸੰਦ ਕਰਦੀਆਂ ਹਨ ਉਹ ਬੋਲੀਆਂ ਪਾ ਪਾ ਕੇ ਬਹੁਤ ਜ਼ਿਆਦਾ ਡਾਂਸ ਕਰਦੀਆਂ ਹਨ ਅਤੇ ਉਹ ਉਹ ਬਹੁਤ ਜ਼ਿਆਦਾ ਮਨੋਰੰਜਨ ਪੈਦਾ ਕਰਦੀਆਂ ਹਨ ਅਤੇ ਜਿਵੇਂ ਕਿ ਮੁੰਡੇ ਹੋ ਗਏ ਉਹ ਭੰਗੜਾ ਪਾ ਕੇ ਆਪਣਾ ਪੂਰਾ ਸ਼ੌਕ ਪ ਪੂਰਾ ਕਰਦੇ ਹਨ ਅਤੇ ਲੇਡੀਜ਼ ਵਗੈਰਾ ਡਾਂਸ ਕਰਦੀਆਂ ਹਨ ਉਹਨਾਂ ਨੂੰ ਬੱਬੂ ਮਾਨ ਦੇ ਗਾਣੇ ਅੰਮ੍ਰਿਤ ਮਾਨ ਦੇ ਗਾਣੇ ਮਨਕੀਰਤ ਔਲਖ ਦੇ ਗਾਣੇ ਬਹੁਤ ਵਧੀਆ ਲੱਗਦੇ ਹਨ ਉਹਨਾਂ 'ਤੇ ਪੂਰਾ ਆਪਣਾ ਜੋਸ਼ ਨਾਲ ਡਾਂਸ ਕਰਦੀਆਂ ਹਨ ਅਤੇ ਬਹੁਤ ਮਜ਼ੇ ਕਰਦੀਆਂ ਹਨ ਵਿਆਹ ਦੇ ਵਿੱਚ ਲੋਕ ਬਹੁਤ ਮਜ਼ੇ ਕਰਦੇ ਹਨ ਅਤੇ ਖਾਣ ਪੀਣ ਦਾ ਉਹਨਾਂ ਨੂੰ ਬਹੁਤ ਸ਼ੌਕ ਹੁੰਦਾ ਹੈ ਅਤੇ ਡਾਂਸ ਕਰਨ ਦਾ ਹੈ ਨਾ ਅਤੇ ਉਹ ਉਹ ਉਹ ਬਹੁਤ ਜ਼ਿਆਦਾ ਫੇਮਸ ਗਾਣੇ ਲਗਾਉਂਦੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਦਾ ਪੂਰਾ ਜੋਸ਼ ਹੋਵੇ ਅਤੇ ਪੂਰੇ ਜੋਸ਼ ਨਾਲ ਨੱਚਣ ਮੁੰਡੇ ਅਤੇ ਕੁੜੀਆਂ ਦੋਨਾਂ ਹੀ ਮੁੰ ਮੁੰ ਮੁੰ ਮੁੰਡੇ ਆਪਣਾ ਭੰਗੜਾ ਪਾ ਲੈਂਦੇ ਹਨ ਅਤੇ ਕੁੜੀਆਂ ਬਹੁਤ ਜ਼ਿਆਦਾ ਡਾਂਸ ਕਰਦੀਆਂ ਹਨ ਅਤੇ ਇਸ ਲਈ ਆਪਾਂ ਵਿਆਹ ਨੂੰ ਬਹੁਤ ਜ਼ਿਆਦਾ ਆਨੰਦ ਮਾਣਦੇ ਹਨ